ਸਕੂਲ ਦੇ ਵਿੱਚ ਸਾਡਾ ਇੱਕ ਟੀਚਰ ਸੀ ਗੁਰਚਰਨ ਸਿੰਘ ਜਿਹੜਾ ਡਰਾਇੰਗ ਮਾਸਟਰ ਹੁੰਦਾ ਸੀ ਅਸੀਂ ਨੇ ਉਹਨਾਂ ਕੋਲ ਡਰਾਇੰਗ ਸਿੱਖੀ ਸੀ ਸਾਨੂੰ ਉਹ ਬੜੇ ਪਿਆਰ ਨਾਲ ਸਿਖਾਉਂਦੇ ਸੀ ਅਤੇ ਜਦੋਂ ਵੀ ਸਾਨੂੰ ਪਹਿਲਾਂ ਤਾਂ ਬਲੈਕ ਬੋਰਡ 'ਤੇ ਸਿਖਾਉਂਦੇ ਸੀ ਫਿਰ ਅਸੀਂ ਉਹਨੂੰ ਆਪਣੇ ਡਰਾਇੰਗ 'ਤੇ ਤਾਰ ਲੈਂਦੇ ਸੀ ਅਤੇ ਸਾਨੂੰ ਫਿਰ ਉਹ ਵਿੱਚ ਉਹਨਾਂ ਦੇ ਰੰਗ ਭਰਨੇ ਵੀ ਦੱਸਦੇ ਸੀ ਵੀ ਇਹਦੇ ਵਿੱਚ ਆਹ ਰੰਗ ਭਰਿਆ ਜਾਊਗਾ ਅਤੇ ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਪੇਂਟਿੰਗ ਸਿੱਖ ਗਏ ਸੀ ਪਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਸੀ ਵੀ ਅਸੀਂ ਉਹਨੂੰ ਚੰਗੀ ਤਰ੍ਹਾਂ ਸਿੱਖ ਲਈਏ ਇਸ ਕਰਕੇ ਅਸੀਂ ਚੰਗੀ ਤਰ੍ਹਾਂ ਉਹਨੂੰ ਨਹੀਂ ਸਿੱਖ ਸਕੇ